ਅੱਜ ਮੈਂ ਅਤੇ ਮੇਰਾ ਪਰਿਵਾਰ ਗਰਮੀ ਦੀਆਂ ਛੁੱਟੀਆਂ ਦਾ ਲਾਹਾ ਲੈਂਦੇ ਹੋਏ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹਾਂ ਇਸ ਲਈ ਅੱਜ ਸਾਨੂੰ ਰਾਤ ਨੂੰ ਬਾਰ੍ਹਾਂ ਵਜੇ ਬਠਿੰਡਾ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਫੜਨੀ ਪੈਣੀ ਹੈ ਪਰ ਇਸ ਸਮੇਂ ਅਸੀਂ ਕਿਸੇ ਗੁਆਂਢੀ ਜਾਂ ਰਿਸ਼ਤੇਦਾਰ ਨੂੰ ਵੀ ਨਾਲ ਨਹੀਂ ਲੈ ਜਾ ਸਕਦੇ ਇਸ ਕਰਕੇ ਸਾਨੂੰ ਬਠਿੰਡਾ ਤੋਂ ਓਲਾ ਕੈਬ ਦੀ ਜ਼ਰੂਰਤ ਹੈ ਜੋ ਮੇਰੇ ਪਿੰਡ ਬਾਦਲ ਤੋਂ ਬਠਿੰਡਾ ਰੇਲਵੇ ਸਟੇਸ਼ਨ ਲੈ ਜਾ ਸਕੇ ਕੀ ਇਹ ਡਰਾਈਵਰ ਗਿਆਰ੍ਹਾਂ ਵਜੇ ਮੇਰੇ ਪਿੰਡ ਬਾਦਲ ਪਹੁੰਚ ਸਕਦਾ ਹੈ ਸਾਨੂੰ ਇਸ ਦੀ ਜਾਣਕਾਰੀ ਮੇਰੇ ਨੰਬਰ ਸਤਾਸੀ ਛੇ ਸੌ ਚੁਰਾਨਵੇਂ ਜ਼ੀਰੋ ਚੌਂਹਠ ਨੱਬੇ ਉੱਪਰ ਜਲਦੀ ਦਿੱਤੀ ਜਾਵੇ ਤਾਂ ਜੋ ਅਸੀਂ ਇਸ ਪੱਖੋਂ ਬੇਚਿੰਤ ਹੋ ਜਾਈਏ ਅਤੇ ਆਪਣੀ ਤਿਆਰੀ ਵਿੱਚ ਜੁੜ ਜਾਈਏ ਕਿਰਪਾ ਕਰਕੇ ਡਰਾਈਵਰ ਨੂੰ ਛੇਤੀ ਸਾਡੇ ਕੋਲ ਪਹੁੰਚਣ ਦੀ ਪਹੁੰਚਣ ਲਈ ਭੇਜਿਆ ਜਾਵੇ ਤਾਂ ਕਿ ਅਸੀਂ ਬਿਨਾ ਟਾਈਮ ਗਵਾਏ ਰੇਲਵੇ ਸਟੇਸ਼ਨ ਬਠਿੰਡਾ ਪਹੁੰਚ ਸਕੀਏ ਅਤੇ ਉੱਥੋਂ ਆਪਣੀ ਰੇਲ ਗੱਡੀ ਫੜਨ ਲਈ ਟਿਕਟਾਂ ਲੈ ਕੇ ਨਿਸ਼ ਬੇਚਿੰਤ ਹੋ ਕੇ ਸਟੇਸ਼ਨ ਦੇ ਉੱਪਰ ਜਾ ਪਹੁੰਚੀਏ ਧੰਨਵਾਦ